ਖੇਤੀ ਮੱਛੀ ਪਾਲਣ ਪਸ਼ੂ ਪਾਲਣ ਡੇਰੀ ਉਤਪਾਦ ਖੇਤੀਬਾੜੀ ਵਿੱਚ ਟੈਕਨੋਲਜੀ ਨੇ ਸਾਡੀ ਬਹੁਤ ਮਦਦ ਕੀਤੀ ਹੈ ਉਹ ਚੀਜ਼ਾਂ ਸਾਨੂੰ ਸੌਖੀਆਂ ਬਣਾ ਦਿੰਦੀਆਂ ਹਨ ਜਿਵੇਂ ਡੇਰੀ ਡੇਰੀ ਏ ਦੁਗਦ ਕ੍ਰਿਸ਼ੀ ਦੀ ਕੁਝ ਖਾਸ ਖਾਸਤਾ ਵੀ ਹਨ ਡੇਰੀ ਕ੍ਰਿਸ਼ੀ ਵਿੱਚ ਤਾਂ ਜ਼ਿਆਦਾ ਪੂੰਜੀ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ ਇਹਦੇ ਵਿੱਚ ਪਸ਼ੂਆਂ ਦੇ ਖਿਆਲ ਰੱਖਣ ਦੁੱਧ ਦੇਣ ਲਈ ਜਿਹੜੇ ਸ਼੍ਰਮਣੀਕਾ ਦੀ ਬਹੁਤ ਜ਼ਰੂਰਤ ਹੁੰਦੀ ਹੈ ਡੈਰੀ ਦੀ ਕ੍ਰਿਸ਼ੀ ਦੇ ਵਿੱਚ ਪਸ਼ੂਆਂ ਨੂੰ ਸਵਸਥ ਦੁੱਧ ਉਤਪਾਦ ਦੇ ਪ੍ਰਬੰਧ ਕਲਿਆਣ ਦਾ ਵੀ ਧਿਆਨ ਦਿੱਤਾ ਜਾਂਦਾ ਹੈ ਡੈਰੀ ਕ੍ਰਿਸ਼ੀ ਦੇ ਉੱਚ ਪ੍ਰਬੰਧ ਲਈ ਤਕਨੀਕੀ ਆਧਾਰ ਵੀ ਬਣ ਗਏ ਹਨ ਵਿਗਿਆਨਿਕ ਤਰੀਕੇ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ ਡੈਰੀ ਕ੍ਰਿਸ਼ੀ ਦੇ ਵਿੱਚ ਦੁੱਧ ਦੇਣ ਵਾਲਿਆਂ ਨੂੰ ਬਵੇਸ਼ੀਆਂ ਦਾ ਪ੍ਰਜਨਨ ਦੇਖਭਾਲ ਦੁੱਧ ਦੀ ਖਰੀਦ ਇਹਨਾਂ ਦੀ ਪ੍ਰੋਸੈਸਿੰਗ ਜਿਵੇਂ ਵੀ ਕੰਮ ਕੀਤੇ ਜਾਂਦੇ ਹਨ ਡੈਰੀ ਕ੍ਰਿਸ਼ੀ ਵਿੱਚ ਤਾਂ ਗਾਵਾਂ ਦੇ ਇਲਾਵਾ ਬੱਕਰੀਆਂ ਭੇਡਾਂ ਊਠਾਂ ਦਾ ਵੀ ਪਾਲਣ ਕੀਤਾ ਜਾਂਦਾ ਹੈ ਡੈਰੀ ਕ੍ਰਿਸ਼ੀ ਦੇ ਵਿੱਚ ਕੈਲਸ਼ੀਅਮ ਪ੍ਰੋਟੀਨ ਵਿਟਾਮਿਨ ਪੌਸ਼ਕ ਤੱਤਵ ਨੇ ਉਹਨਾਂ ਨੂੰ ਭਰਪੂਰ ਮਾਤਰਾ ਵਿੱਚ ਡੈਰੀ ਦੀ ਵਰਤੋਂ ਮਿਲਦੀ ਹੈ ਡੈਰੀ ਦੇ ਵਿੱਚ ਕ੍ਰਿਸ਼ੀ ਦੇ ਕਿਸਾਨਾਂ ਨੂੰ ਅਜੀਵਿਕਾ ਵੀ ਮਿਲ ਜਾਂਦੀ ਹੈ ਰੁਜ਼ਗਾਰ ਵੀ ਮਿਲ ਜਾਂਦਾ ਹੈ ਇਹਦੇ ਵਿੱਚ ਗ੍ਰਾਮੀਣ ਸਮਤਾਵਾਂ ਵਿੱਚ ਵੀ ਸਹਾਇਤਾ ਮਿਲਦੀ ਹੈ ਅਰਥ ਵਿਵਸਥਾ ਵੀ ਮਜ਼ਬੂਤ ਹੁੰਦੀ ਹੈ ਇਹਨਾਂ ਦੀ ਉਤਪੰਨ ਕ੍ਰਿਸ਼ੀ ਵੀ ਹੁੰਦੀ ਹੈ ਦੁਧਾਰੂ ਪਸ਼ੂਆਂ ਨੂੰ ਵੀ ਪਾਲਿਆ ਜਾਂਦਾ ਹੈ ਪੂੰਜੀ ਦੀ ਬਖਸ਼ਤਾ ਵੀ ਹੁੰਦੀ ਹੈ ਪਸ਼ੂਆਂ ਨੂੰ ਚਰਾਣਾ ਦੁੱਧ ਨਿਕਾਲਣਾ ਇਹਨਾਂ ਵਿੱਚ ਵੀ ਸ਼ਰਮ ਦੀ ਲੋੜ ਹੁੰਦੀ ਹੈ ਪਸ਼ੂਆਂ ਦੀ ਦੇਖ ਰੇਖ ਵੀ ਕੀਤੀ ਜਾਂਦੀ ਹੈ ਇਹਨਾਂ ਨੂੰ ਪੂਰਾ ਸਾਲ ਹੀ ਵੇਖਣਾ ਪੈਂਦਾ ਹੈ ਇਹਨਾਂ ਦੇ ਵਿੱਚ ਆਪਾਂ ਨੂੰ ਬਹੁਤ ਬਹੁਤ ਵੱਡੇ ਸ਼ੇਤਰਾਂ ਵਿੱਚ ਜਿਵੇਂ ਯੂਰੋਪ ਅਮੈਰੀਕਾ ਨਿਊਜ਼ੀਲੈਂਡ ਆਸਟਰੇਲੀਆ ਇਹਨਾਂ ਵਿੱਚ ਵੀ ਬਹੁਤ ਬਹੁਤ ਸ਼ੇਤਰ ਹੈਗੇ ਹਨ ਇਹਨਾਂ ਦੇ ਵਿੱਚ ਡੈਰੀ ਫਾਰਮ ਤਾਂ ਬੜਾ ਹੀ ਆਪਣਾ ਮਹੱਤਵ ਬਣਾ ਦਿੰਦੀਆਂ ਹਨ ਇਹਨਾਂ ਵਿੱਚ ਪੂੰਜੀ ਤਕਨੀਕੀ ਕਈ ਵਿਸ਼ੇਸ਼ਤਾਵਾਂ ਮਿਲਦੀਆਂ ਹਨ ਇਹਨਾਂ ਵਿੱਚ ਤਾਂ ਪਸ਼ੂਆਂ ਨੂੰ ਚਿਕਿਤਸਾ ਵੀ ਦੇਣ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿਸੇ ਉਦਯੋਗਿਕ ਕੇਂਦਰ ਵਿੱਚ ਨੇੜੇ ਵਿੱਚ ਆਇਆ ਜਾਂਦਾ ਹੈ ਅੱਛੀ ਅੱਛੀ ਖਪਤ ਵੀ ਮਿਲ ਜਾਂਦੀ ਹੈ ਆਪਾਂ ਨੂੰ ਇਹਨਾਂ ਦੇ ਵਿੱਚ ਬਹੁਤ ਹੀ ਪਸ਼ੂ ਪਾਲਣ ਵਿੱਚ ਵਪਾਰਿਕ ਸਤਰ 'ਤੇ ਉੱਚਾ ਕੀਤਾ ਜਾਂਦਾ ਹੈ ਕ੍ਰਿਸ਼ੀ ਫਾਰਮ ਵਿੱਚ ਪਸ਼ੂਆਂ ਨੂੰ ਚਾ ਚਾਰਾ ਦੇਣ ਵਾਲਾ ਦੁੱਧ ਦੇਣ ਵਾਲੀਆਂ ਗਾਂ ਭੈਂਸ ਆਦਿ ਦੇ ਵਿਗਿਆਨਿਕ ਤਰੀਕੇ ਵੀ ਅਪਣਾਏ ਜਾਂਦੇ ਹਨ ਇਹਨਾਂ ਵਿੱਚ ਤਾਂ ਆਪਾਂ ਨੂੰ ਤਕਨੀਕੀ ਸਹਾਇਤਾ ਬਹੁਤ ਮਿਲਦੀਆਂ ਹਨ ਆਪਾਂ ਤਾਂ ਇਹਨਾਂ ਤਕਨੀਕੀ ਸਹਾਇਤਾ ਦੇ ਜ਼ਰੀਏ ਹੀ ਆਪਦੇ ਸ਼੍ਰਮ ਨੂੰ ਪੂੰਜੀ ਨੂੰ ਅਧਿਕ ਤੋਂ ਅਧਿਕ ਅੱਗੇ ਲਿਜਾਨੇ ਹਾਂ ਇਹਨਾਂ ਵਿੱਚ ਪਸ਼ੂਆਂ ਨੂੰ ਉਸਾਰੀ ਪ੍ਰਜਨਨ ਪਸ਼ੂ ਚਕਿਤਸਾ ਬਹੁਤ ਹੀ ਨਵੇਂ ਨਵੇਂ ਚੀਜ਼ਾਂ ਮਿਲਦੀਆਂ ਹਨ ਇਹਦੇ ਵਿੱਚ ਕਿਸੇ ਡਿਜੀਟਲ ਦੇ ਨਾਲ ਜ਼ਰੀਏ ਧੋਖਾਧੜੀ ਦੇ ਚਾਂਸ ਵੀ ਖਤਮ ਹੋ ਜਾਂਦੇ ਆ ਟਰਾਂਜੈਕਸ਼ਨ ਦਾ ਡਿਜੀਟਲ ਵੀ ਹੋ ਜਾਂਦਾ ਹੈ ਜਿਵੇਂ ਆਪਾਂ ਕਿਸੇ ਮੁੱਦਰਾ ਨੂੰ ਅੱਗੇ ਕਰਨਾ ਹੋਵੇ ਆਪਾਂ ਨੂੰ ਹੋਵੇ ਆਪਾਂ ਨੂੰ ਮਿਲ ਜਾਂਦਾ ਹੈ ਆਪਾਂ ਇਸ ਨਾਲ ਬਹੁਤ ਕੰਮ ਪੈਸੇ ਸ ਕਮਾ ਸਕਦੇ ਹਾਂ ਆਪਾਂ ਇਹਨਾਂ ਨਾਲ ਬਹੁਤ ਹੀ ਬੜੇ ਬੜੇ ਕੰਮ ਕਰ ਲੈਂਦੇ ਹਾਂ ਆਪਾਂ ਨੂੰ ਬਹੁਤ ਫਾਇਦੇ ਹਨ ਇਸ ਕਰਕੇ ਆਪਾਂ ਨੂੰ ਇਹਨਾਂ ਤਕਨੀਕੀਆਂ ਨੇ ਬਹੁਤ ਹੀ ਮਹੱ ਮਦਦ ਕੀਤੀ ਹੈ ਅਤੇ ਬਹੁਤ ਹੀ ਆਪਾਂ ਨੂੰ ਸੌਖਾ ਬਣਾ ਦਿੱਤਾ ਗਿਆ ਹੈ